ਜੇਕਰ ਮੈਂ ਗੱਲ ਕਰਾਂ ਕਿ ਮੇਰਾ ਭੈਣ ਭਾਈ ਜਾਂ ਪੁੱਤ ਧੀ ਕਿੰਨੀ ਕੁ ਸਿੱਖਿਆ ਪੂਰੀ ਕਰੇ ਤਾਂ ਜਿਵੇਂ ਮੈਂ ਘਰ ਦੇ ਵਿੱਚ ਸਭ ਤੋਂ ਵੱਡੀ ਹੋਣ ਦੇ ਨਾਤੇ ਮੈਂ ਹਮੇਸ਼ਾਂ ਹੀ ਚਾਹੁੰਦੀ ਸੀ ਕਿ ਜਿਹੜੇ ਮੇਰੇ ਛੋਟੇ ਭੈਣ ਭਾਈ ਆ ਉਹ ਮੇਰੇ ਤੋਂ ਵੀ ਜ਼ਿਆਦਾ ਉਚੇਰੀ ਵਿੱਦਿਆ ਹਾਸਲ ਕਰਨ ਜਿਹੜੀਆਂ ਕਮੀਆਂ ਮੇਰੇ ਵਿੱਚ ਰਹਿ ਗਈਆਂ ਸੀ ਉਹ ਉਹ ਆਪਣੀਆਂ ਉਹਨਾਂ ਦੇ ਥਰੂ ਮੈਂ ਉਹਨਾਂ ਨੂੰ ਪੂਰਾ ਕਰਨਾ ਚਾਹੁੰਦੀ ਸੀ ਸੋ ਮੈਂ ਹਰ ਟਾਈਮ ਚਾਹੁੰਦੀ ਸੀ ਕਿ ਉਹ ਮੇਤੋਂ ਵੀ ਜ਼ਿਆਦਾ ਟੈਕਨੋਲੋਜੀ ਵਾਲੇ ਯੁੱਗ ਵਿੱਚ ਜਾਣ ਜਿਵੇਂ ਕਿ ਮੈਂ ਦੱਸਾਂ ਕਿ ਮੈਂ ਬੀ ਟੈੱਕ ਕੰਪਿਊਟਰ ਸਾਇੰਸ ਦੇ ਵਿੱਚ ਕੀਤੀ ਹੋਈ ਆ ਤਾਂ ਮੈਂ ਹਰ ਵਾਰ ਮੈਨੂੰ ਇਹੀ ਹੁੰਦਾ ਸੀ ਕਿ ਮੇਰਾ ਭੈਣ ਭਾਈ ਹੈ ਉਹ ਇੱਕ ਤਾਂ ਆਪਣੀ ਜਿਹਦੇ ਉਹ ਜਿੱਥੇ ਉਹਨਾਂ ਦਾ ਇੰਟਰਸਟ ਹੈ ਉਹ ਕੋਰਸ ਤਾਂ ਲੈਣ ਹੀ ਲੈਣ ਬਟ ਜੋ ਅੱਜ ਕੱਲ੍ਹ ਲੇਟੈਸਟ ਚੱਲ ਰਿਹਾ ਅਕੋਰਡਿੰਗ ਟੂ ਟੈਕਨੋਲੋਜੀ ਆਪਾਂ ਕਹਿ ਸਕਦੇ ਹਾਂ ਜਾਂ ਉਹ ਅਕੋਰਡਿੰਗ ਟੂ ਜੋ ਅੱਜ ਕੱਲ੍ਹ ਜਿਹਦਾ ਦੌਰ ਚੱਲ ਰਿਹਾ ਉਹਦੇ ਅਕੋਰਡਿੰਗ ਉਹ ਆਪਣਾ ਕੋਰਸ ਚੂਜ਼ ਕਰਨ ਅਤੇ ਉਹ ਮੇਤੋਂ ਵੀ ਜ਼ਿਆਦਾ ਉਚੇਰੀ ਵਿੱਦਿਆ ਵੱਲ ਜਾਣ ਕਿਉਂਕਿ ਬਿਨਾਂ ਵਿੱਦਿਆ ਤੋਂ ਬਿਨਾਂ ਕੁਛ ਵੀ ਨਹੀਂ ਹੈ ਸਿੱਖਿਆ ਤੋਂ ਬਿਨਾਂ ਬੰਦਾ ਕੁਛ ਵੀ ਨਹੀਂ ਹੈ ਉਹਦਾ ਸਟੇਟਸ ਇੱਕ ਸਿੱਖਿਆ ਦੇ ਨਾਲ਼ ਹੀ ਹੈ ਜੇ ਉਹਨੂੰ ਉਹ ਐਜੂਕੇਟਡ ਹੈ ਉਹ ਤਾਂ ਹੀ ਅੱਜ ਦੇ ਜ਼ਮਾਨੇ ਵਿੱਚ ਵਿਚਰ ਸਕਦਾ ਤਾਂ ਤੁਹਾਡੇ ਸਮਾਜਿਕ ਅਤੇ ਵਿਕਾਸ ਵਾਸਤੇ ਮਾਨਸਿਕ ਵਿਕਾਸ ਵਾਸਤੇ ਸਿੱਖਿਆ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਅਤੇ ਮੈਂ ਚਾਹਾਂਗੀ ਕਿ ਮੇਰੇ ਭੈਣ ਭਾਈ ਜਾਂ ਪੁੱਤ ਧੀ ਬਹੁਤ ਉਚੇਰੀ ਵਿੱਦਿਆ ਹਾਸਲ ਕਰਨ